ਯੋਗ ਦਾ ਅਭਿਆਸ ਕਰਨ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਫ਼ਾਇਦੇ ਹੋਏ ਹਨ ਜਿਵੇਂ ਕਿ ਪਹਿਲਾਂ ਮੈਂ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਿੰਦੀ ਸੀ ਪਰ ਜਦੋਂ ਦਾ ਮੈਂ ਯੋਗਾ ਕਰਨ ਲੱਗੀ ਹਾਂ ਇਸ ਤੋਂ ਬਾਅਦ ਮੈਨੂੰ ਕੋਈ ਵੀ ਟੈਨਸ਼ਨ ਨਹੀਂ ਰਹਿੰਦੀ ਡਲ ਬਲਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਰਲੈਕਸ ਫੀਲ ਕਰਦੀ ਹਾਂ ਇਸ ਦੇ ਨਾਲ ਹੀ ਪਹਿਲਾਂ ਮੈਂ ਇੱਕ ਜ਼ਿਆਦਾ ਟਾਈਮ ਤੱਕ ਕਿਸੇ ਵੀ ਇੱਕ ਚੀਜ਼ 'ਤੇ ਧਿਆਨ ਨਹੀਂ ਦੇ ਪਾਉਂਦੀ ਸੀ ਪਰ ਹੁਣ ਮੈਂ ਰੀਡਿੰਗ ਉੱਪਰ ਜ਼ਿਆਦਾ ਧਿਆਨ ਦੇ ਪਾਉਂਦੀ ਹਾਂ ਕਿਉਂਕਿ ਮੈਂ ਕੋਨਸੈਂਟ ਮੇਰੀ ਕੋਨਸਟਰੇਸ਼ਨ ਪਾਵਰ ਵੱਧ ਚੁੱਕੀ ਹੈ ਜਦੋਂ ਦੀ ਮੈਂ ਮੈਡੀਟੇਸ਼ਨ ਅਤੇ ਯੋਗਾ ਕਰਦੀ ਹਾਂ ਇਸ ਨਾਲ ਮੇਰੀ ਕੋਨਸਟਰੇਸ਼ਨ ਪਾਵਰ ਦੇ ਨਾਲ ਨਾਲ ਮੈਂ ਬਹੁਤ ਜ਼ਿਆਦਾ ਤੰਦਰੁਸਤ ਵੀ ਰਹਿੰਦੀ ਹਾਂ ਇਸ ਤੋਂ ਬਾਅਦ ਬਿਮਾਰੀਆਂ ਲੱਗਣ ਦਾ ਖ਼ਤਰਾ ਮੈਨੂੰ ਘੱਟ ਚੁੱਕਾ ਹੈ ਇਸ ਦੇ ਨਾਲ ਹੀ ਮੈਂ ਜ਼ਿਆਦਾ ਫਲੈਕਸੀਬਲ ਵੀ ਹੋ ਗਈ ਹਾਂ ਇਸ ਨਾਲ ਨਾਲ ਮੇਰੇ ਫੇਸ ਉੱਤੇ ਜ਼ਿਆਦਾ ਚਮਕ ਉੱਠ ਚੁੱਕੀ ਹੈ ਅਤੇ ਮੇਰੇ ਵਾਲ ਵੀ ਲੰਬੇ ਹੋ ਗਏ ਹਨ ਯੋਗਾ ਕਰਨ ਦੇ ਹੋਰ ਵੀ ਬਹੁਤ ਜ਼ਿਆਦਾ ਫ਼ਾਇਦੇ ਮੈਨੂੰ ਮਿਲੇ ਹਨ ਜੇ ਜਿਵੇਂ ਕਿ ਜਦੋਂ ਵੀ ਮੈਂ ਕਿਸੇ ਵੀ ਚੀਜ਼ ਉੱਤੇ ਧਿਆਨ ਦਿੰਦੀ ਹਾਂ ਤਾਂ ਉਸ ਉੱਪਰ ਉਸ ਤੋਂ ਮੇਰਾ ਧਿਆਨ ਨਹੀਂ ਭਟਕਦਾ ਬਲਕਿ ਇਸ ਤੋਂ ਯੋਗਾ ਕਰਨ ਤੋਂ ਪਹਿਲਾਂ ਮੇਰਾ ਧਿਆਨ ਭਟਕਦਾ ਰਹਿੰਦਾ ਸੀ ਧੰਨਵਾਦ